ਕਿਸਾਨ ਜਾਨਵਰਾਂ ਦੀ ਰਹਿੰਦ ਖੁੰਹਦ ਦਾ ਪ੍ਰਬੰਧ ਕਈ ਤਰੀਕਿਆਂ ਨਾਲ ਕਰ ਸਕਦੇ ਹਨ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਸਲੱਰੀ ਹੁੰਦੀ ਹੈ ਸਲੱਰੀ ਕਹਿੰਦੇ ਆ ਜਿਹੜਾ ਪਿਸ਼ਾਪ ਗੋਹਾ ਅਤੇ ਉਸ ਫਰਸ਼ ਨੂੰ ਧੋਅ ਕੇ ਜਿਹੜਾ ਪਾਣੀ ਦੇ ਨਾਲ ਸਾਰਾ ਮਿਕਸ ਹੋ ਕੇ ਲਿਕੁਇਡ ਮਿਨਔਰ ਬਣ ਜਾਂਦਾ ਉਹਨੂੰ ਸਲੱਰੀ ਕਹਿੰਦੇ ਉਹਨੂੰ ਅਸੀਂ ਦੋ ਤਰੀਕਿਆਂ ਨਾਲ ਵਰਤ ਸਕਦੇ ਹਾਂ ਇੱਕ ਤਰੀਕਾ ਹੈ ਬਾਇਓਗੈਸ ਦਾ ਬਾਇਓਗੈਸ ਦਾ ਪਲਾਂਟ ਬਣ ਜਾਂਦਾ ਉਹ ਉਹਦੇ ਵਿੱਚ ਕੀ ਹੁੰਦਾ ਕਿ ਥੱਲੇ ਡੂੰਘਾ ਟੋਆ ਹੁੰਦਾ ਉਹਦੇ ਉੱਤੇ ਉੱਤੇ ਜਦੋਂ ਕਿਉਂਕਿ ਇਹਦੇ ਵਿੱਚ ਮੀਥੇਨ ਗੈਸ ਬਣਦੀ ਹੈ ਜਿੱਦਾਂ ਜਾਨਵਰਾਂ ਦਾ ਗੋਹਾ ਹੁੰਦਾ ਉਹਦੀ ਮੀਥੇਨ ਗੈਸ ਬਣਨ ਕਰਕੇ ਮੀਥੇਨ ਗੈਸ ਇੱਕ ਜਵਲਨਸ਼ੀਲ ਗੈਸ ਹੈ ਜਿਹਨੂੰ ਅਸੀਂ ਇਕੱਠਾ ਕਰਕੇ ਅਤੇ ਪਾਈਪ ਰਾਹੀ ਪਾਈਪ ਲਾਈਨ ਰਾਹੀਂ ਘਰਾਂ ਦੇ ਵਿੱਚ ਵੀ ਸਪਲਾਈ ਕਰ ਸਕਦੇ ਹਾਂ ਦੂਸਰਾ ਕੰਮ ਹੈ ਕਿ ਇਹ ਸਲੈਰੀ ਨੂੰ ਡਾਇਰੈਕਟਲੀ ਤੁਸੀਂ ਫਿਸ਼ ਫਾਰਮਿੰਗ ਦੇ ਨਾਲ ਲਿੰਕ ਕਰ ਦਿਓ ਉੱਧਰ ਨੂੰ ਭੇਜ ਦਿਓ ਕਿਉਂਕਿ ਇਹਦੇ ਵਿੱਚ ਜਿਹੜੇ ਅਣਪਚੇ ਮਟੀਰੀਅਲ ਹੁੰਦੇ ਨੇ ਉਹ ਮੱਛੀਆਂ ਵਾਸਤੇ ਭੋਜਨ ਦਾ ਕੰਮ ਕਰਦੇ ਆ ਅਤੇ ਉਹਦੇ ਵਿੱਚ ਫਿਸ਼ ਫਾਰਮਿੰਗ ਵਿੱਚ ਇੱਕ ਤਾਂ ਫੀਡ ਦੀ ਕੋਸਟ ਘੱਟ ਜਾਂਦੀ ਹੈ ਦੂਜਾ ਫਿਸ਼ ਦੀ ਗਰੋਥ ਬੜੀ ਵਧੀਆ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਨਾਈਟ੍ਰੋਜਨ ਰਿਚ ਪ੍ਰੋਡਕਟ ਆਉਂਦੇ ਨੇ ਤੀਸਰਾ ਤਰੀਕਾ ਕਿ ਜਿੱਦਾਂ ਇਕੱਲਾ ਗੋਹਾ ਤੁਸੀਂ ਉਹਨੂੰ ਇਕੱਠਾ ਕਰ ਲਓ ਅਤੇ ਗੋਹੇ ਨੂੰ ਐਜ਼ ਆ ਫਰਟੀਲਾਈਜ਼ਰ ਵਰਤੋ ਖਾਦ ਦੇ ਦੌਰ 'ਤੇ ਵਰਤੋਂ ਉ ਇਹਦੇ ਨਾਲ ਜ਼ਮੀਨ ਦੇ ਵਿੱਚ ਜਦੋਂ ਤੁਸੀਂ ਰੂੜੀ ਨੂੰ ਇਹਨੂੰ ਰੂੜੀ ਕਹਿੰਦੇ ਆ ਜਿਹੜੀ ਗਲ ਸੜ ਜਾਂਦੀ ਹੈ ਇਸ ਰੂੜੀ ਨੂੰ ਪਾਉਂਦੇ ਹੋ ਤਾਂ ਫਰਟੀਲਿਟੀ ਜਿਹੜੀ ਹੈ ਉਹ ਸ ਲੈਂਡ ਦੀ ਵੱਧ ਜਾਂਦੀ ਹੈ ਅਤੇ ਦੂਸਰੀਆਂ ਖਾਦਾਂ ਜਿਹੜੀਆਂ ਸਨਥੈਟਿਕ ਖਾਦਾਂ ਨੇ ਉਹ ਘੱਟ ਪਾਉਣੀਆਂ ਪੈਂਦੀਆਂ ਹਨ ਇੱਕ ਚੌਥਾ ਤਰੀਕਾ ਹੋਰ ਆ ਕਿ ਕਈ ਲੋਕ ਇਸਨੂੰ ਪਾਥੀਆਂ ਬਣਾ ਕੇ ਐਜ਼ ਆ ਪਾਥੀਆਂ ਵੀ ਜਿਹਦੇ ਵਿੱਚ ਕਿ ਇਹਨੂੰ ਗੋਹੇ ਨੂੰ ਥੋੜ੍ਹੀ ਜਿਹੀ ਮਿੱਟੀ ਅਤੇ ਥੋੜ੍ਹਾ ਜਿਹਾ ਵਿੱਚ ਸੁੱਕੀ ਤੂੜੀ ਜਾਂ ਪਰਾਲੀ ਕੋਈ ਪਾ ਕੇ ਮਿਕਸ ਕਰਕੇ ਅਤੇ ਉਹਦੇ ਨਾਲ ਇਹ ਪਾਥੀਆਂ ਬਣਾ ਲੈਂਦੇ ਨੇ ਅਤੇ ਉਹ ਪਾਥੀਆਂ ਜਿਹੜੀਆਂ ਉਹਦੇ ਨਾਲ ਕਹਿ ਲਓ ਕਿ ਇੰਧਨ ਦਾ ਵੀ ਕੰਮ ਕਰਦੀਆਂ ਨੇ